ਮੈਂ ਆਪਣੇ ਘਰ ਦੀ ਸਫਾਈ ਦਾ ਪੂਰਾ ਧਿਆਨ ਰੱਖਦੀ ਹਾਂ ਨਾਲ ਹੀ ਮੈਨੂੰ ਆਪਣੇ ਘਰ ਦੇ ਬਾਹਰ ਆਪਣਾ ਆਲਾ ਦੁਆਲਾ ਸਾਫ ਰੱਖਣ ਦਾ ਬਹੁਤ ਸ਼ੌਂਕ ਹੈ ਇਸ ਲਈ ਮੈਂ ਆਪਣੇ ਘਰ ਦੇ ਬਾਹਰ ਬਹੁਤ ਛੋਟੇ ਛੋਟੇ ਅਤੇ ਕੁਛ ਵੱਡੇ ਵੀ ਪੋਦੇ ਲਗਾਏ ਹੋਏ ਹਨ ਜਿਹਨਾਂ ਦੀ ਦੇਖਰੇਖ ਮੈਂ ਆਪ ਕਰਦੀ ਹਾਂ ਟਾਈਮ ਨਾਲ ਉਹਨਾਂ ਨੂੰ ਪਾਣੀ ਦਿੰਦੀ ਹਾਂ ਖਾਦ ਸਭ ਕੁਛ ਬਾਕੀ ਵੀ ਧਿਆਨ ਦਿੰਦੀ ਹਾਂ ਸਾਡੇ ਘਰ ਦੇ ਬਾਹਰ ਬਿਲਕੁਲ ਵੀ ਕੂੜਾ ਨਾ ਹੋਵੇ ਇਸ ਦਾ ਵੀ ਮੈਂ ਪੂਰਾ ਧਿਆਨ ਰੱਖਦੀ ਹਾਂ ਤਾਂ ਕਿ ਜਦੋਂ ਜਮਾਦਾਰ ਆਏ ਸਾਰਾ ਕੂੜਾ ਉਸ ਦੇ ਡਰੰਮ ਵਿੱਚ ਹੀ ਪਾਉਂਦੇ ਹਾਂ ਅਤੇ ਇੱਧਰ ਉੱਧਰ ਨਹੀਂ ਖਿਲਾਰਦੇ ਜੋ ਵੀ ਗਲੀ ਵਿੱਚ ਜਮਾਦਾਰ ਸਾਫ ਸਫਾਈ ਕਰਨ ਆਉਂਦਾ ਹੈ ਜੇ ਉਹ ਨਾ ਆਵੇ ਤਾਂ ਅਸੀਂ ਖੁਦ ਆਪਣੇ ਮੁਹੱਲੇ ਦੀ ਦੇਖਰੇਖ ਕਰਦੇ ਹਾਂ ਤਾਂ ਕਿ ਜੋ ਸਾਡਾ ਆਲਾ ਦੁਆਲਾ ਸਾਫ ਸੁਥਰਾ ਰਵੇ ਅਤੇ ਅਸੀਂ ਬਿਮਾਰੀਆਂ ਤੋਂ ਦੂਰ ਰਹੀਏ ਸਾਡੇ ਕਲੋਨੀ ਦੇ ਬਾਹਰ ਵੀ ਇੱਕ ਪਾਰਕ ਹੈ ਅਸੀਂ ਉਸ ਦੀ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਦੇ ਹਾਂ ਤਾਂ ਜੋ ਸਾਰੇ ਆਨੰਦ ਲੈ ਸਕਣ ਬੱਚੇ ਅਤੇ ਵੱਡੇ ਵੀ